ਮੇਰਾ ਪੇਂਟ ਕਰਨ ਲਈ ਮਨ ਪਸੰਦ ਵਿਸ਼ਾ ਇੱਕ ਨਹੀਂ ਕਾਫ਼ੀ ਸਾਰੇ ਵਿਸ਼ੇ ਹਨ ਇਹਨਾਂ ਵਿੱਚ ਮੇਰੇ ਮੂੜ 'ਤੇ ਡਿਪੈਂਡ ਹੁੰਦੇ ਹਨ ਜਿਸ ਤਰ੍ਹਾਂ ਮੈਂ ਕਿਸੇ ਧਾਰਮਿਕ ਸਥਾਨ 'ਤੇ ਬੈਠਾ ਹਾਂ ਉੱਥੇ ਧਾਰਮਿਕ ਚਿੱਤਰ ਮੇਰੇ ਦਿਮਾਗ 'ਚ ਆਉਂਦੇ ਹਨ ਅਤੇ ਮੈਂ ਘਰ ਆ ਕੇ ਧਾਰਮਿਕ ਚਿੱਤਰ ਤਿਆਰ ਕਰਦਾ ਹਾਂ ਅਗਰ ਮੈਂ ਕਿਤੇ ਖੁੱਲ੍ਹੇ ਵਾਤਾਵਰਨ ਵਿੱਚ ਹੋਵਾਂ ਜਿਵੇਂ ਬਨਸਪਤੀ ਅਤੇ ਕੋਈ ਕੁਦਰਤ 'ਤੇ ਕੁਦਰਤੀ ਕ੍ਰਿਸ਼ਮੇ 'ਤੇ ਜਾਂ ਕਿਸੇ ਜਾਨਵਰ ਜਾਂ ਕੋਈ ਬਿਲਡਿੰਗ ਜਿਸ ਤਰ੍ਹਾਂ ਦਾ ਵੀ ਮੌਸਮ ਹੁੰਦਾ ਹੈ ਜਿਸ ਤਰ੍ਹਾਂ ਦਾ ਵੀ ਮਾਹੌਲ ਬਣਦਾ ਹੈ ਮੈਂ ਉਸ ਤਰ੍ਹਾਂ ਹੀ ਮੇਰਾ ਮੂੜ ਉਸ 'ਤੇ ਡਿਪੈਂਡ ਹੈ ਅਗਰ ਜਿਸ ਤਰ੍ਹਾਂ ਕਿ ਮੈਂ ਸੱਤ 'ਤੇ ਬੈਠਾ ਹਾਂ ਉੱਥੋਂ ਇੱਕ ਬਹੁਤ ਸੁੰਦਰ ਚਿੜੀਆਂ ਦਾ ਝੁੰਡ ਲੰਘਿਆ ਸੀ ਫਿਰ ਮੈਂ ਉਸ ਨੂੰ ਆਪਣੀ ਡਰਾਇੰਗ ਪੇਪਰ 'ਤੇ ਉਸ ਤਰ੍ਹਾਂ ਬਣਾ ਕੇ ਦੇਖਿਆ ਫਿਰ ਉਸ ਦੇ ਵਿੱਚ ਰੰਗ ਭਰੇ ਰੰਗ ਭਰ ਕੇ ਉਹੇ ਜਿਹਾ ਸਮਾਂ ਬਣਾਇਆ ਅਤੇ ਉਹ ਮੇਰੇ ਮਨ ਨੂੰ ਬਹੁਤ ਵਧੀਆ ਲੱਗਿਆ ਮੈਂ ਆਪਣੇ ਮਨ ਦੇ ਸਕੂਨ ਦੇ ਹਿਸਾਬ ਨਾਲ ਚੱਲਦਾ ਹਾਂ ਮੇਰਾ ਕੋਈ ਇੱਕ ਮਨਪਸੰਦ ਵਿਸ਼ਾ ਨਹੀਂ ਹੈ ਮੇਰੇ ਕਈ ਮਨਪਸੰਦ ਵਿਸ਼ੇ ਹਨ